ਜਿਵੇਂ ਕਿ ਇਹ ਇੱਕ ਸੁਭਾਵਿਕ ਜਿਹੀ ਗੱਲ ਹੈ ਕਿ ਹਰ ਘਰ ਦੇ ਵਿੱਚ ਖਾਣਾ ਬਣਦਾ ਹੈ ਅਤੇ ਉਸ ਖਾਣੇ ਨੂੰ ਬਣਾਉਣ ਲਈ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਦੋਂ ਅਸੀਂ ਖਾਣਾ ਬਣਾਉਂਦੇ ਅਤੇ ਖਾਂਦੇ ਹਾਂ ਅਤੇ ਬਰਤਨ ਤਾਂ ਜੂਠੇ ਹੁੰਦੇ ਹੀ ਹਨ ਅਤੇ ਉਹਨਾਂ ਬਰਤਨਾਂ ਨੂੰ ਧੋਣ ਦੀ ਵੀ ਇੱਕ ਪ੍ਰਕਿਰਿਆ ਹੁੰਦੀ ਹੈ ਬਰਤਨਾਂ ਨੂੰ ਸਾਫ ਸੁਥਰੇ ਢੰਗ ਨਾਲ ਧੋਣਾ ਅਤੇ ਉਹਨਾਂ ਨੂੰ ਸਾਫ ਰੱਖਣਾ ਵੀ ਇੱਕ ਖਾਸ ਤਕਨੀਕ ਅਤੇ ਪ੍ਰਕਿਰਿਆ ਰਾਹੀ ਹੁੰਦਾ ਹੈ ਪਹਿਲਾਂ ਤਾਂ ਜਿੰਨੇ ਵੀ ਜੂਠੇ ਬਰਤਨ ਹੁੰਦੇ ਹਨ ਉਹਨਾਂ ਨੂੰ ਸਿੰਕ ਵਿੱਚ ਰੱਖ ਕੇ ਪਹਿਲਾਂ ਪਾਣੀ ਦੇ ਨਾਲ ਧੋਤਾ ਜਾਂਦਾ ਹੈ ਪਾਣੀ ਦੇ ਨਾਲ ਉਹਨਾਂ ਦੀ ਜੂਠ ਨੂੰ ਲਾਹ ਕੇ ਉਹਨਾਂ ਨੂੰ ਸਾਫ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਕੋਈ ਵੀ ਸਾਬਣ ਜੋ ਤੁਸੀਂ ਵਰਤਦੇ ਹੋ ਜਾਂ ਸਰਫ ਵਰਤਦੇ ਹੋ ਭਾਂਡੇ ਧੋਣ ਵਾਲਾ ਉਹ ਲੈ ਕੇ ਇੱਕ ਸਾਫ ਸੁਥਰੀ ਜੁਰਾਬ ਦੇ ਨਾਲ ਉਸ ਸਰਫ ਜਾਂ ਉਸ ਸਾਬਣ ਦੇ ਨਾਲ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਉਹਨਾਂ ਦੇ ਉੱਤੇ ਉਹ ਜੁਰਾਬ ਫੇਰ ਕੇ ਸਾਰੀ ਜੂਠ ਲਾਹੀ ਜਾਂਦੀ ਹੈ ਜੂਠ ਲਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਉਹ ਭਾਂਡਿਆਂ ਨੂੰ ਪਾਣੀ ਦੇ ਨਾਲ ਧੋ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੈਲ ਕੋਈ ਜੂਠ ਕੋਈ ਸਬਜ਼ੀ ਜਾਂ ਕੁਝ ਵੀ ਲੱਗਾ ਨਾ ਰਹਿ ਜਾਵੇ ਅਤੇ ਜਿਹੜੇ ਤੇਲ ਵਾਲੇ ਭਾਂਡੇ ਹੁੰਦੇ ਹਨ ਉਹਨਾਂ ਨੂੰ ਸਾਫ ਕਰਨ ਲਈ ਇੱਕ ਖਾਸ ਤਰ੍ਹਾਂ ਦੀ ਤਕਨੀਕ ਵਰਤੀ ਜਾਂਦੀ ਹੈ ਉਹ ਹੈ ਗਰਮ ਪਾਣੀ ਪਹਿਲਾਂ ਪਾਣੀ ਨੂੰ ਗਰਮ ਕਰ ਲਿਆ ਜਾਂਦਾ ਹੈ ਅਤੇ ਉਸ ਤੇਲ ਵਾਲੇ ਭਾਂਡੇ ਦੇ ਵਿੱਚ ਪਾ ਲਿਆ ਜਾਂਦਾ ਹੈ ਅਤੇ ਫਿਰ ਉਹਦੀ ਸਾਰੀ ਚਿਕਨਾਈ ਉਤਰ ਜਾਂਦੀ ਹੈ ਅਤੇ ਫਿਰ ਉਹਨੂੰ ਉਸ ਸਾਬਣ ਦੀ ਜੁਰਾਬ ਮਾਰ ਕੇ ਧੋ ਦਿੱਤਾ ਜਾਂਦਾ ਹੈ ਅਤੇ ਸਾਫ ਕਰ ਲਿਆ ਜਾਂਦਾ ਹੈ ਧੰਨਵਾਦ